ਗਿਆਨੀ ਜੈਲ ਸਿੰਘ ਨਗਰ ਦਸ਼ਮੇਸ਼ ਨਗਰ ਸੰਨਸਿਟੀ ਇਹ ਅਜਿਹੇ ਸਥਾਨਕ ਰਿਹਾਇਸ਼ੀ ਵਿਕਲਪ ਹਨ ਜਿੱਥੇ ਕਿ ਲੋਕਾਂ ਨੂੰ ਰਹਿਣ ਦੇ ਲਈ ਕ ਕਿਰਾਏ 'ਤੇ ਰਹਿਣ ਦੇ ਲਈ ਜਾਂ ਫਿਰ ਆਪਣਾ ਮਕਾਨ ਬਣਾਉਣ ਦੇ ਲਈ ਜਗ੍ਹਾ ਹੈ ਜਿਹੜੀ ਉਹ ਮ ਮਿਲ ਜਾਂਦੀ ਹੈ ਇਨ੍ਹਾਂ ਜਿਹੇ ਇਲਾਕਿਆਂ ਦੇ ਵਿੱਚ ਕਿਰਾਏ 'ਤੇ ਲੈਣ ਲਈ ਬਣੇ ਹੋਏ ਮਕਾਨ ਵੀ ਮਿਲ ਜਾਂਦੇ ਹਨ ਅਗਰ ਅਸੀਂ ਇਨ੍ਹਾਂ ਜਗ੍ਹਾ ਵਿੱਚ ਖੁੱਲ੍ਹੇ ਪਲਾਟ ਲੈਣਾ ਚਾਹੁੰਦੇ ਹਾਂ ਤਾਂ ਇਨ੍ਹਾਂ ਜਗ੍ਹਾ ਦੇ ਵਿੱਚ ਸਾਨੂੰ ਖੁੱਲ੍ਹੇ ਪਲਾਟ ਵੀ ਨੇ ਜਿਹੜੇ ਉਹ ਮਿਲ ਜਾਂਦੇ ਹਨ ਇੱਥੇ ਰਹਿਣ ਦਾ ਕਿਰਾਇਆ ਵੀ ਨੋਰਮਲ ਹੀ ਹੁੰਦਾ ਹੈ ਅੱਠ ਕੁ ਹਜ਼ਾਰ ਰੁਪਏ ਤੋਂ ਲੈ ਕੇ ਦਸ ਹਜ਼ਾਰ ਰੁਪਏ ਤੱਕ ਵਧੀਆ ਮਕਾਨ ਦੋ ਕਮਰਿਆਂ ਇੱਕ ਰਸੋਈ ਅਤੇ ਗੈਲਰੀ ਵਾਲਾ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਵੱਡੇ ਮਕਾਨ ਵੀ ਪੰਦਰਾਂ ਹਜ਼ਾਰ ਰੁਪਏ ਦੇ ਵਿੱਚ ਮਿਲ ਜਾਂਦੇ ਹਨ